ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਮਨ ਗੱਲ ਕਰ ਰਿਹਾ ਸੀ ਮੈਂ ਤੁਹਾਡੀ ਵੈੱਬਸਾਈਟ ਤੋਂ ਇੱਕ ਆਈਫ਼ੋਨ ਥਰਟੀਨ ਮੰਗਵਾਇਆ ਸੀ ਜੋ ਮੈਨੂੰ ਟਾਈਮ 'ਤੇ ਡਿਲੀਵਰ ਹੋ ਗਿਆ ਹੈ ਅਤੇ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ ਹਾਂ ਇਸਦਾ ਕੈਮਰਾ ਬਹੁਤ ਅੱਛਾ ਹੈ ਅਤੇ ਇਸਦੀ ਸਪੀਕਰ ਕੁਆਲਿਟੀ ਵੀ ਮੈਨੂੰ ਬਹੁਤ ਚੰਗੀ ਲੱਗੀ ਅਤੇ ਸਭ ਤੋਂ ਚੰਗੀ ਗੱਲ ਮੈਂ ਇਸਦਾ ਡਾਰਕ ਬਲੂ ਕਲਰ ਮੰਗ ਮੰਗਵਾਇਆ ਸੀ ਅਤੇ ਜੋ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਜੋ ਤੁਸੀਂ ਕਲਰ ਵੈੱਬਸਾਈਟ 'ਤੇ ਮੈਂ ਦਿਖਾਇਆ ਉਹੀ ਸੇਮ ਕਲਰ ਮੇਰੇ ਕੋਲ ਪਹੁੰਚਿਆ ਇਸਦੀ ਨੈੱਟਵਰਕ ਕਨੈਕਟੀਵੀਟੀ ਵੀ ਬਹੁਤ ਅੱਛੀ ਹੈ ਮਤਲਬ ਕਿ ਮੇਰਾ ਵਾਈਫਾਈ ਇਸ 'ਚ ਬਹੁਤ ਅੱਛਾ ਚੱਲ ਰਿਹਾ ਹੈ ਅਤੇ ਇਸਦਾ ਪ੍ਰੋਸੈਸਰ ਵੀ ਬਹੁਤ ਅੱਛਾ ਹੈ ਮੈਨੂੰ ਕੋਈ ਲੈਗ ਵਾਲੀ ਪ੍ਰੋਬਲਮ ਨਹੀਂ ਆ ਰਹੀ ਥੈਂਕ ਯੂ